ਹੈਲੋ ਸਤਿ ਸ਼੍ਰੀ ਅਕਾਲ ਮੈਮ ਟ੍ਰੈਫਿਕ ਪੁਲਿਸ ਤੋਂ ਗੱਲ ਕਰ ਰਹੇ ਹੋ ਮੈਡਮ ਥੋੜ੍ਹੀ ਅਵੇਅਰਨੈਸ ਵਾਸਤੇ ਕੰਪਲੇਂਟ ਕਰਨੀ ਸੀ ਮੈਡਮ ਮੈਂ ਅੱਜ ਕੱਲ੍ਹ ਟ੍ਰੈਫਿਕ ਪੁਲਿਸ ਵਾਸਤੇ ਕੁਝ ਨੌਕਰੀ ਔਖੀ ਹੋ ਗਈ ਹੈ ਕੇ ਮੈਡਮ ਅੱਜ ਕੱਲ੍ਹ ਟ੍ਰੈਫਿਕ ਸੜਕਾਂ 'ਤੇ ਕਾਫ਼ੀ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਕੀ ਗੱਲ ਹੈ ਨਹੀਂ ਮੈਡਮ ਮੈਂ ਰੋਡ 'ਤੇ ਜਾਂਦੇ ਵਖਤ ਇੱਕ ਓਵਰ ਸਪੀਡਿੰਗ ਲਾਈਟਾਂ ਨੂੰ ਕ੍ਰੋਸ ਕਰਦੇ ਹੋਏ ਲੋਕ ਕਈ ਵਿਖ ਜਾਂਦੇ ਆ ਮੈਡਮ ਇਹਨਾਂ 'ਤੇ ਥੋੜ੍ਹਾ ਧਿਆਨ ਦਿਓ ਇਹ ਕਾਫ਼ੀ ਦਿੱਕਤ ਬਣ ਰਿਹਾ ਕਈ ਹਾਦਸਿਆਂ ਦਾ ਕਾਰਨ ਬਣ ਰਿਹਾ ਇਹ ਵਾਲਾ ਇਹਦਾ ਮੈਡਮ ਥੋੜ੍ਹਾ ਕੰਟਰੋਲ ਕਰੋ ਇਹਦੇ ਨਾਲ ਕਈ ਲੋਕਾਂ ਦੀ ਜਾਨ ਜਾ ਰਹੀ ਹੈ ਅਤੇ ਹਾਂਜੀ ਹਾਂਜੀ ਮੈਡਮ ਇਹ ਤਾਂ ਬਹੁਤ ਵੱਡਾ ਇਸ਼ੂ ਬਣ ਚੁੱਕਿਆ ਜੋ ਸੜਕਾਂ ਉੱਪਰ ਹਾਦਸੇ ਹੋ ਰਹੇ ਨੇ ਮੈਡਮ ਥੋੜ੍ਹਾ ਨਾ ਇੱਥੇ ਫ਼ਾਜ਼ਿਲਕਾ ਇਲਾਕੇ ਵਿੱਚ ਵੀ ਲਾਈਟਾਂ ਵਾਲੇ ਚੌਂਕ 'ਤੇ ਕਾਫ਼ੀ ਜ਼ਿਆਦਾ ਹਾਦਸੇ ਹੋ ਰਹੇ ਨੇ ਉਹ ਲਾਈਟਾਂ ਨੂੰ ਕ੍ਰੋਸ ਕਰਦੇ ਆ ਬਿਨਾਂ ਵੇਖੇ ਹਾਂਜੀ ਹਾਂਜੀ ਅਤੇ ਹੋਰ ਹੈ ਕਾਫ਼ੀ ਦਿੱਕਤਾਂ ਹੈਗੀਆਂ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਆਪਣੇ ਆਪ ਕੰਟਰੋਲ ਕਰੇ ਨਹੀਂ ਮੈਡਮ ਅਜੇ ਇਹ ਹੀ ਨਹੀਂ ਗੇ ਇਸ ਤੋਂ ਬਹੁਤ ਜ਼ਿਆਦਾ ਵੱਧ ਚੁੱਕਿਆ ਜੋ ਕਿ ਆਪਾਂ ਦੇਖਦੇ ਹਾਂ ਵੀ ਬਜ਼ੁਰਗਾਂ ਨੂੰ ਲੁੱਟ ਖੋਹ ਆਮ ਹੀ ਹੋ ਜਾਂਦੀ ਆ ਰੋਡ 'ਤੇ ਉਹਦੇ ਵਾਸਤੇ ਵੀ ਟ੍ਰੈਫਿਕ ਪੁਲਿਸ ਨੂੰ ਚਾਹੀਦਾ ਕਿ ਕੁਝ ਓਵਰਸਪੀਡਿੰਗ ਨੂੰ ਕੰਟਰੋਲ ਕਰੇ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਉਹ ਵੀ ਓਵਰਸਪੀਡਿੰਗ ਵਾਲੇ ਆਉਂਦੇ ਆ ਅਤੇ ਭਜਾ ਕੇ ਚਲੇ ਜਾਂਦੇ ਆ ਅਤੇ ਉਹਨਾਂ ਨੂੰ ਪਕੜਨਾ ਵੀ ਔਖਾ ਹੋ ਜਾਂਦਾ ਹੈ ਨੇੜੇ ਦੇ ਲੋਕਾਂ ਨੂੰ ਹਾਂਜੀ ਹਾਂਜੀ ਮੈਡਮ ਹਾਂਜੀ ਅਤੇ ਬਾਕੀ ਤੁਸੀਂ ਕੋਸ਼ਿਸ਼ ਤਾਂ ਕਰ ਰਹੇ ਹੋ ਬਾਕੀ ਕੰਟਰੋਲ ਵੀ ਜ਼ਰੂਰੀ ਹੈ ਠੀਕ ਹੈ ਜੀ ਧੰਨਵਾਦ ਮੈਡਮ